ਸੰਗੀਤ ਦੇ ਵਿੱਚ ਆਪਾਂ ਜੇ ਪਸੰਦੀਦਾ ਸ਼ੈਲੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਆਪਣੇ ਮਤਲਬ ਆਪਾਂ ਕਹਿ ਲਈਏ ਵੀ ਸੰਗੀਤਕਾਰ ਨੇ ਹੈ ਨਾ ਤਾਂ ਹਰ ਕਿਸੇ ਦਾ ਆਪਦਾ ਅਲੱਗ ਅਲੱਗ ਮਤਲਬ ਗਾਉਣ ਦਾ ਤਰੀਕਾ ਹੁੰਦਾ ਤਾਂ ਕੋਈ ਆਪਾਂ ਕਹਿ ਲਈਏ ਸਾਰੇ ਦੇਸ਼ ਭਗਤੀ ਦੇ ਹੀ ਸੰਗੀਤ ਦੇ ਵਿੱਚ ਮਤਲਬ ਇਕੱਲਾ ਦੇਸ਼ ਭਗਤੀ ਦਾ ਹੀ ਕੋਈ ਗਾਉਂਦਾ ਹੈ ਨਾ ਤਾਂ ਕਈ ਆਪਾਂ ਕਹਿ ਲਈਏ ਵੀ ਕਈ ਸੱਭਿਆਚਾਰਕ ਹੋ ਗਏ ਜਿੱਦਾਂ ਵੀ ਇੱਕ ਸੱਭਿਆਚਾਰਕ ਹੀ ਬੰਦਾ ਕੋਈ ਗਾਉਂਦਾ ਤਾਂ ਇੱਦਾਂ ਆਪਾਂ ਕਹਿ ਲਈਏ ਹਰ ਗਾਇਕ ਦਾ ਆਪਦਾ ਇੱਕ ਪਸੰਦੀਦਾ ਉਹ ਹੁੰਦਾ ਅਤੇ ਮੇਰੀ ਰਾਏ ਦੇ ਵਿੱਚ ਆਪਾਂ ਦੇਖੀਏ ਤਾਂ ਮੈਨੂੰ ਮਤਲਬ ਸੱਭਿਆਚਾਰਕ ਜ਼ਿਆਦਾ ਪਸੰਦ ਨੇ ਸੱਭਿਆਚਾਰਕ ਆਪਾਂ ਕਹਿ ਲਈਏ ਵੀ ਕਿਉਂ ਪਸੰਦ ਨੇ ਤਾਂ ਦੇਖੋ ਵੀ ਆਪਣਾ ਜਿਹੜਾ ਪੁਰਾ ਪੁਰਾਤਨ ਪੰਜਾਬੀ ਸੱਭਿਆਚਾਰ ਹੈ ਬੜਾ ਅਮੀਰ ਸੱਭਿਆਚਾਰ ਹੈ ਤਾਂ ਕਿਤੇ ਨਾ ਕਿਤੇ ਅੱਜ ਕੱਲ੍ਹ ਦੇ ਜਿਹੜੇ ਗਾਇਕ ਨੇ ਹੈ ਨਾ ਵੀ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਦਿਖਾਈਆਂ ਜਾਂਦੀਆਂ ਉਹਦੇ 'ਚ ਦੇਖੋ ਅਸਲਾ ਹਥਿਆਰ ਮਤਲਬ ਇਹਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਕੱਲ੍ਹ ਗਾਇਕ ਵੀ ਦੇਖੋ ਬਹੁਤ ਘੱਟ ਹੀ ਨੇ ਜਿਹੜੀ ਆਪਣੇ ਪੁਰਾਤਨ ਜਿਹੜਾ ਸੰਗੀਤ ਸੀ ਹੈ ਨਾ ਪੁਰਾਤਨ ਸੱਭਿਆਚਾਰ ਸੀ ਉਹਦੀ ਗੱਲ ਕਰਦੇ ਆ ਤਾਂ ਮੈਨੂੰ ਕਿਤੇ ਨਾ ਕਿਤੇ ਦੇਖੋ ਸੱਭਿਆਚਾਰਕ ਹੀ ਮਤਲਬ ਜ਼ਿਆਦਾ ਪਸੰਦ ਹੈ